ਇੱਕ ਸਪੋਰਟਸ ਸਕਾਲਰਸ਼ਿਪ ਇੱਕ ਕਿਸਮ ਦੀ ਸਕਾਲਰਸ਼ਿਪ ਹੁੰਦੀ ਹੈ ਜਿਹੜੀ ਵੀ ਕਿਸੇ ਵੀ ਵਿਅਕਤੀ ਨੂੰ ਕਿਸੇ ਖਾਸ ਖੇਡ ਖੇਡ ਨੂੰ ਖੇਡਣ ਦੇ ਯੋਗਤਾ ਦੇ ਆਧਾਰ 'ਤੇ ਯੂਨੀਵਰੱਸਟੀ ਜਾਣ ਦੇ ਲਈ ਦਿੱਤੀ ਜਾਂਦੀ ਹੈ ਇਹ ਵਿਦਿਆਰਥੀ ਨੂੰ ਕਿਸੇ ਵੀ ਖਾਸ ਖੇਡ ਦੇ ਵਿੱਚ ਆਪਦੀ ਜਿਹੜੀ ਪ੍ਰਤਿਭਾ ਗੀ ਉਹਨੂੰ ਅੱਗੇ ਵਧਾਉਣ ਦੇ ਲਈ ਉਤਸ਼ਾਹਿਤ ਕਰਦੀ ਹੈ ਵੀ ਜੋ ਜਿਹੜਾ ਭਾਰਤ ਆ ਨੂੰ ਆ ਸਾਡੀ ਅਗਲੀ ਜਿਹੜੀ ਉੱਭਰਦੀ ਹੋਈ ਖੇਡ ਸ਼ਖਸੀਅਤ ਹੈ ਉਹ ਪ੍ਰਦਾਨ ਕਰ ਦਿੰਦੀ ਹੈ ਕ੍ਰਿਕੇਟ ਲਈ ਸਕਾਲਰਸ਼ਿਪ ਆ ਜਿਹੜੀ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਵੀ ਜਿਹੜੀ ਕਿ ਸ ਨੇੜੇ ਦੇ ਸਕੂਲ ਜਾਂ ਕਾਲਜ ਨੇ ਉਹਨਾਂ ਨੂੰ ਸਕਾਲਰਸ ਲਿਸਟ ਕਰਕੇ ਜੇ ਜਿਹੜੀ ਕ੍ਰਿਕਟ ਖਿਡਾਰੀਆਂ ਲਈ ਵਜ਼ੀਫੇ ਦੀ ਪੇਸ਼ਕਸ਼ ਕਰ ਸਕਦੇ ਨੇ ਖੇਡ ਨਿਰਦੇਸ਼ਕਾਂ ਨਾਲ ਗੱਲਬਾਤ ਕਰਕੇ ਅਤੇ ਕਿਸੇ ਮਾਹਰ ਜਾਂ ਕੋਰਸ ਦੇ ਅਧੀਨ ਸਿਖਲਾਈ ਜਾਰੀ ਕਰਕੇ ਕ੍ਰਿਕਟ ਖਿਡਾਰੀਆਂ ਲਈ ਵਜ਼ੀਫੇ ਦੀ ਪੇਸ਼ਕਸ਼ ਲਈ ਵਾਲੀ ਸੰਸਥਾ ਦੀ ਮਾਪਦੰਡਾਂ ਨੂੰ ਸਮਝ ਕੇ